ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਖੇਡਾਂ ਦੇ ਖੇਤਰ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਅਤੇ ਮੁੱਦੇ ਹਨ ਜਿਵੇਂ ਕਿ ਅੱਜ ਕੱਲ੍ਹ ਲੋਕ ਫੋਨ ਦੀਆਂ ਐਪਸ ਜਿਵੇਂ ਰੀਲਾਂ ਇੰਸਟਾਗਰਾਮ ਸਪੈਸ਼ਲੀ ਆਪਾਂ ਦੇਖ ਲਈਏ ਰੀਲਾਂ ਬਣਾਉਣ 'ਚ ਏ ਬਹੁਤ ਸਾਰੇ ਵਿਅਸਤ ਹਨ ਅਤੇ ਲੋਕ ਇਹਨਾਂ ਪਿੱਛੇ ਇੰਨੇ ਕੁ ਜ਼ਿਆਦਾ ਪਾਗਲ ਹਨ ਕਿ ਇਹਨਾਂ ਦਾ ਕੋਈ ਹੱਲ ਵੀ ਹੈ ਨਹੀਂ ਲੋਕ ਸਪੋਰਟਸ ਵਾਲੀ ਵੱਲ ਜਾਣਾ ਬਹੁਤ ਹੀ ਘੱਟ ਇੰਟਰਸਟ ਰੱਖਦੇ ਹਨ ਕਈ ਲੋਕ ਜਿਵੇਂ ਪੈਸਿਆਂ ਦੀ ਭੱਜ ਦੌੜ 'ਚ ਫੋਰਨ ਕੰਟਰੀਜ਼ 'ਚ ਜਾ ਕੇ ਸ਼ਿਫਟ ਹੋ ਰਹੇ ਹਨ ਕੋਈ ਇੱਕ ਗੌਰਮੈਂਟ ਜੋਬ ਕਰ ਰਿਹਾ ਹੈ ਕਿਸੇ ਕੋਈ ਲੋਕਾਂ ਕੋਲ ਸਪੋਰਟਸ ਵਾਸਤੇ ਕੋਈ ਟਾਈਮ ਹੀ ਹੈ ਨਹੀਂ ਜੇ ਕਿਸੇ ਨੂੰ ਸਪੋਰਟਸ ਵਿੱਚ ਥੋੜ੍ਹਾ ਬਹੁਤਾ ਵੀ ਇੰਟਰਸਟ ਹੈਗਾ ਤਾਂ ਉਹ ਬਸ ਬਲੋਕ ਲੈਵਲ ਤੱਕ ਹੀ ਖੇਡਦਾ ਹੈ ਅਤੇ ਬਾਕੀ ਅੱਗੇ ਉਹਨੂੰ ਨਾ ਤਾਂ ਕੋ ਕੋਈ ਉਹਨੂੰ ਚੰਗੀ ਤਰ੍ਹਾਂ ਗਾਈਡ ਕਰਨ ਵਾਸਤੇ ਹੈ ਅਤੇ ਨਾ ਹੀ ਕੋਈ ਉਹਦੀ ਹੈਲਪ ਕਰਦਾ ਹੈ ਇਸ ਲਈ ਉਸ ਨੂੰ ਜੇ ਉਹ ਵੱਡਾ ਖਿਡਾਰੀ ਬਣਨਾ ਚਾਹੁੰਦਾ ਹੈ ਤਾਂ ਉਹਨੂੰ ਜਿਵੇਂ ਕੋਚ ਪ੍ਰੋਵਾਈਡ ਕਰਦੇ ਹੈਗੇ ਆ ਆਪਾਂ ਕੋਚ ਲਈ ਬਹੁਤ ਹੀ ਮਹਿੰਗੀਆਂ ਫੀਸਾਂ ਮੰਗੀਆਂ ਜਾਂਦੀਆਂ ਹਨ ਜੋ ਕਿ ਗਰੀਬ ਘਰ ਦੇ ਕਿਸੇ ਵੀ ਬੱਚੇ ਲਈ ਦੇਣਾ ਮੁਸ਼ਕਿਲ ਹੈ ਅੱਜ ਕੱਲ੍ਹ ਕੋਚ ਵੀ ਬਹੁਤ ਜ਼ਿਆਦਾ ਲਾਲਚੀ ਹੋ ਗਏ ਹਨ ਉਹ ਵੀ ਕੁਛ ਬੱਚਿਆਂ ਨੂੰ ਖੇਡਾਂ ਦੇ ਕੁਛ ਰੂਲਸ ਸਿਖਾਉਣ ਲਈ ਬਹੁਤ ਵੱਡੀ ਅਮਾਊਂਟ ਮੰਗਦੇ ਹਨ ਜੋ ਕਿ ਗਰੀਬ ਬੱਚਿਆਂ ਕੋਲੋਂ ਦਿੱਤੀ ਨਹੀਂ ਜਾਂਦੀ ਪਰ ਉਹ ਬਹੁਤ ਵਧੀਆ ਖਿਡਾਰੀ ਹੁੰਦੇ ਹਨ ਅਤੇ ਪੈਸਿਆਂ ਕਾਰਨ ਅਤੇ ਵਧੀਆ ਕੋਚ ਨਾ ਮਿਲਣ ਕਾਰਨ ਉਹ ਭਵਿੱਖ ਵਿੱਚ ਅੱਗੇ ਨਹੀਂ ਵੱਧ ਸਕਦੇ ਅਤੇ ਉਹ ਇੱਕ ਚੰਗੇ ਖਿਡਾਰੀ ਨਹੀਂ ਬਣ ਸਕਦੇ ਜੋ ਬਹੁਤ ਵਧੀਆ ਖਿਡਾਰੀ ਹੁੰਦੇ ਹਨ ਜਿਹਨਾਂ ਵਿੱਚ ਟੈਲੈਂਟ ਹੁੰਦਾ ਹੈ ਉਹ ਹਰੇਕ ਖਿਡਾਰੀ ਨੂੰ ਐਵੇਂ ਹੁੰਦਾ ਹੈ ਕਿ ਮੈਂ ਉਹਦੇ ਤੋਂ ਵੀ ਅੱਗੇ ਨਿਕਲਾਂ ਉਹਦੇ ਤੋਂ ਵੀ ਅੱਗੇ ਨਿਕਲਾਂ ਇਸ ਵਿਚ ਇਸ ਚੀਜ਼ ਦੀ ਵਰਤੋਂ ਕਾਰਨ ਉਹ ਆਪਣੇ ਸਰੀਰ ਨੂੰ ਵੱਧ ਤੋਂ ਵੱਧ ਐਨਰਜੀ ਦੇਣ ਲਈ ਕਈ ਦਵਾਈਆਂ ਅਤੇ ਟੀਕਿਆਂ ਦੀ ਵਰਤੋਂ ਕਰਦੇ ਹਨ ਜਿਹੜਾ ਕਿ ਉਹਨਾਂ ਦੇ ਸਿਹਤ 'ਤੇ ਬਹੁਤ ਹੀ ਮਾੜਾ ਪ੍ਰਭਾਵ ਪਾਉਂਦੀਆਂ ਹਨ ਅੱਜ ਕੱਲ੍ਹ ਲੋਕਾਂ 'ਚ ਭਰਿਸ਼ਟਾਚਾਰ ਦੀ ਭਾਵਨਾਵਾਂ ਬਹੁਤ ਜ਼ਿਆਦਾ ਡਿਵੈਲਪ ਹੋ ਰਹੀ ਹੈ ਉਹ ਇੱਕ ਦੂਜੇ ਦਾ ਉਹ ਪਾਰਟੀਸਪੇਟ ਕਰਨਾ ਜ਼ਰੂਰੀ ਨਹੀਂ ਸਮਝਦੇ ਜਿਸ ਵੀ ਗੇਮ ਵਿੱਚ ਉਹ ਪਾਰਟੀਸਪੇਟ ਕਰਦੇ ਆ ਉਸ ਵਿੱਚ ਉਹ ਫਸਟ ਆਉਣਾ ਵੀ ਲਾਜ਼ਮੀ ਸਮਝਦੇ ਹਨ ਪਰ ਇਹ ਚੀਜ਼ ਗਲਤ ਹੈ ਕਿਉਂਕਿ ਜਦੋਂ ਵੀ ਆਪਾਂ ਕਿਸੇ ਗੇਮ ਜਾਂ ਸਪੋਰਟਸ 'ਚ ਪਾਰਟੀਸਪੇਟ ਕਰਦੇ ਹਨ ਤਾਂ ਉਹਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਇਸ ਗੇਮ ਨੂੰ ਜਿੱਤਾਂ ਹੀ ਇੰਨਾਂ ਵੱਡਾ ਹੀ ਬਹੁਤ ਹੁੰਦਾ ਹੈ ਕਿ ਅਸੀਂ ਕਿਸੇ ਚੀਜ਼ ਜਾਂ ਗੇਮ 'ਚ ਪਾਰਟੀਸਪੇਟ ਕੀਤਾ ਹੈ ਆਹੀ ਸਾਡਾ ਸਭ ਤੋਂ ਵੱਡਾ ਹੁਨਰ ਹੁੰਦਾ ਹੈ ਗੇਮਸ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਭਾਵਨਾਵਾਂ ਸਾਡੇ 'ਚ ਪੈਦਾ ਹੁੰਦੀਆਂ ਜਿਵੇਂ ਸਹਿਣਸ਼ੀਲਤਾ ਜੇ ਅਸੀਂ ਹਾਰੇ ਹਾਂ ਤਾਂ ਸਾਨੂੰ ਹਾਰ ਸਾਡੀ ਖਿੜੇ ਮੱਥੇ ਸਵੀਕਾਰ ਕਰਨੀ ਚਾਹੀਦੀ ਹੈ ਅਤੇ ਜਿਹੜੀ ਟੀਮ ਜਿੱਤੀ ਹੈ ਉਹਨੂੰ ਵਧਾਈਆਂ ਦੇਣੀਆਂ ਚਾਹੀਦੀਆਂ ਹਨ ਏਕਤਾ ਵਿੱਚ ਰਹਿਣਾ ਚਾਹੀਦਾ ਹੈ ਕੋਚ ਜੋ ਸਾਨੂੰ ਰੂਲਸ ਦਿੰਦਾ ਹੈ ਸਾਨੂੰ ਉਹ ਫੋਲੋ ਕਰਨੇ ਚਾਹੀਦੇ ਹੈ ਸਾਨੂੰ ਬਿਨਾਂ ਰੂਲਸ ਤੋਂ ਕੋਈ ਵੀ ਗੇਮ ਨਹੀਂ ਖੇਡਣੀ ਚਾਹੀਦੀ ਗੇਮ 'ਚ ਸਾਨੂੰ ਨਿਯਮਾਂ ਵਿੱਚ ਬੱਧ ਕੇ ਜੀਣ ਦਾ ਤਰੀਕਾ ਦੱਸਦੀਆਂ ਹਨ ਅਗਰ ਅਸੀਂ ਕੋਈ ਵੀ ਗੇਮ ਖੇਡਦੇ ਹਾਂ ਤਾਂ ਉਸਦੇ ਕੁਛ ਨਾ ਕੁਛ ਰੂਲਸ ਹੁੰਦੇ ਹਨ ਜੋ ਸਾਨੂੰ ਫੋਲੋ ਕਰਨੇ ਪੈਂਦੇ ਹਨ ਜੇਕਰ ਅਸੀਂ ਇਸੇ ਤਰ੍ਹਾਂ ਗੇਮਸ ਵਿੱਚ ਹਿੱਸਾ ਲਵਾਂਗੇ ਤਾਂ ਸਾਡ ਅਸੀਂ ਆਪਣੀ ਰੀਅਲ ਲਾਈਫ 'ਚ ਵੀ ਬਹੁਤ ਸਾਰੇ ਰੂਲਸ ਅਪਣਾਵਾਂਗੇ ਪਰ ਅੱਜ ਕੱਲ੍ਹ ਇੱਦਾਂ ਨਹੀਂ ਹੈ ਇੱਕ ਤਾਂ ਜਿਹੜੇ ਟ੍ਰੇਨਿੰਗ ਦਿੰਦੇ ਹੈ ਉਹ ਬਹੁਤ ਜ਼ਿਆਦਾ ਲਾਲਚੀ ਹੋ ਗਏ ਹਨ ਉਹਨਾਂ ਨੂੰ ਵੀ ਪੈਸਿਆਂ ਨਾਲ ਹੀ ਮਤਲਬ ਹੁੰਦਾ ਹੈ ਉਹ ਕਿਸੇ ਵੀ ਸਟੂਡੈਂਟ ਨੂੰ ਗਾਈਡ ਸਹੀ ਗਾਈਡ ਉਦੋਂ ਤੱਕ ਨਹੀਂ ਕਰਦੇ ਜਿਨ ਤੱਕ ਜਿੰਨੀ ਪੇਮੈਂਟ ਜਾਂ ਰਾਸ਼ੀ ਉਹ ਮੰਗਦੇ ਹੈ ਉਹਨਾਂ ਨੂੰ ਨਹੀਂ ਦਿੱਤੀ ਜਾ ਸਕਦੀ ਉਹ ਵੱਡੇ ਘਰਾਂ ਦੇ ਹੀ ਬੱਚਿਆਂ ਨੂੰ ਟ੍ਰੇਨ ਜਾਂ ਕੋਚ ਕਰਨਾ ਜ਼ਰੂਰੀ ਸਮਝਦੇ ਹਨ ਅਤੇ ਜਿਹੜੇ ਬੈਸਟ ਸਟੂਡੈਂਟਸ ਹੁੰਦੇ ਹਨ ਬੈਸਟ ਪਲੇਅਰਸ ਸਪੋਰਟਸਮੈਨ ਜਿਹਨਾਂ ਨੂੰ ਪੈਸਿਆਂ ਦੀ ਦਿੱਕਤ ਕਾਰਨ ਉਹ ਵਧੀਆ ਸਪੋਰਟਸਮੈਨ ਨਹੀਂ ਬਣ ਸਕਦੇ ਧੰਨਵਾਦ